ਇੱਕ ਹਜ਼ਾਰ ਦੋ ਤਿੰਨ ਹਜ਼ਾਰ ਚਾਰ ਸੌ ਸੱਠ ਪੰਜ ਹਜ਼ਾਰ ਦੋ ਸੌ ਨੱਬੇ ਤਿੰਨ ਹਜ਼ਾਰ ਤਿੰਨ ਸੌ ਅੱਸੀ ਗਿਆਰ੍ਹਾਂ ਹਜ਼ਾਰ ਦੋ ਸੌ ਅੱਸੀ